ਸਾਡੇ ਖੇਤਰ ਵਿੱਚ ਬਹੁਤ ਸਾਰੀਆਂ ਕਬਾਇਲੀ ਕਲਾਵਾਂ ਸ਼ਾਮਿਲ ਹਨ ਜੋ ਕਿ ਪੁਰਾਣੇ ਸਮੇਂ ਤੋਂ ਹੀ ਸਾਡੇ ਸਮਾਜ ਦਾ ਇੱਕ ਮਹੱਤਵਪੂਰਨ ਅੰਗ ਰਹੀਆਂ ਹਨ ਅੱਜ ਬਹੁਤ ਸਾਰੇ ਅੱਜ ਸਮਾਜ ਵਿੱਚ ਬਹੁਤ ਸਾਰੇ ਲੋਕ ਇਹਨਾਂ ਕਲਾਵਾਂ ਨੂੰ ਸੰਭਾਲਣ ਲਈ ਯੋਗਦਾਨ ਦੇ ਰਹੇ ਹਨ ਕਲਾਕਾਰ ਆਪਣੀ ਕਲਾ ਨੂੰ ਹੋਰ ਵਧੀਆ ਤਰੀਕੇ ਨਾਲ ਪੇਸ਼ ਕਰਦੇ ਹਨ ਕਲ ਅਤੇ ਇੱਕ ਕਲਾਕਾਰ ਆਪਣੀ ਕਲਾ ਦੇ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਅਤੇ ਆਪਣੇ ਵਿਸ਼ਵਾਸ਼ਾਂ ਨੂੰ ਲੋਕਾਂ ਅੱਗੇ ਪੇਸ਼ ਕਰਦਾ ਹੈ ਅੱਜ ਨੌਜਵਾਨ ਪੀੜ੍ਹੀ ਇਹਨਾਂ ਕਲਾਵਾਂ ਨੂੰ ਸੰਭਾਲਣ ਵਿੱਚ ਆਪਣਾ ਯੋਗਦਾਨ ਦੇ ਰਹੀ ਹੈ ਅੱਜ ਬਹੁਤ ਸਾਰੇ ਕਲਾਕਾਰ ਹਨ ਜਿਵੇਂ ਕਿ ਸੰਗੀਤਕਾਰ ਜਾਂ ਨਾਟਕਕਾਰ ਜਾਂ ਹੋਰ ਵੀ ਜਿਵੇਂ ਨਾਚਕਾਰ ਜੋ ਕਿ ਇਹਨਾਂ ਕਲਾ ਨੂੰ ਸੰਭਲਦੇ ਹਨ ਅਤੇ ਲੋਕਾਂ ਨੂੰ ਆਪਣੀ ਸੱਭਿਆਚਾਰ ਅਤੇ ਸੰਸਕ੍ਰਿਤੀ ਬਾਰੇ ਜੁੜੇ ਰਹਿਣ ਦਾ ਜੁੜੇ ਰਹਿਣ ਲਈ ਯੋਗਦਾਨ ਦਿੰਦੇ ਹਨ